ਜੇ ਆਪਾਂ ਤਰਨ ਤਾਰਨ ਜਿਲ੍ਹੇ ਦੀ ਬਜ਼ੁਰਗ ਆਬਾਦੀ ਦਾ ਗੱਲ ਕਰੀਏ ਤਾਂ ਆਪਾਂ ਨੂੰ ਕਈ ਜਿਹੜੇ ਦ੍ਰਿਸ਼ ਕਹਿ ਲਓ ਉਹ ਦੇਖਣ ਨੂੰ ਮਿਲਦੇ ਆ ਇੱਕ ਤਰਫ ਉਹ ਵਾਲੇ ਬਜ਼ੁਰਗ ਨੇ ਜਿਹੜੇ ਕਿ ਬਿਲਕੁਲ ਵਧੀਆ ਜ਼ਿੰਦਗੀ ਜਿਓ ਰਹੇ ਨੇ ਜਿਵੇਂ ਆਪਣੀ ਜ਼ਿੰਦਗੀ ਦੇ ਕਾਫੀ ਸਾਲ ਉਹਨਾਂ ਨੇ ਨੌਕਰੀ ਕੀਤੀ ਹੁਣ ਰਿਟਾਇਰ ਹੋ ਕੇ ਆਪਣੇ ਬੱਚਿਆਂ ਦੇ ਨਾਲ ਰਹਿੰਦੇ ਨੇ ਰੋਜ਼ ਸਵੇਰੇ ਸ਼ਾਮ ਗੁਰਦੁਆਰੇ ਜਾਂਦੇ ਨੇ ਪਾਠ ਕਰਦੇ ਨੇ ਪਾਰਕਾਂ ਦੇ ਵਿੱਚ ਸੈਰ ਲਈ ਆਉਂਦੇ ਨੇ ਜਾਂ ਆਪਣੇ ਪੋਤੇ ਪੋਤਰੀਆਂ ਦੇ ਨਾਲ ਖੇਡਦੇ ਨੇ ਉਹਨਾਂ ਨੂੰ ਬਾਜ਼ਾਰ ਲੈ ਕੇ ਜਾਂਦੇ ਨੇ ਅਲੱਗ ਅਲੱਗ ਚੀਜ਼ਾਂ ਜਿਹੜੀਆਂ ਆ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਉਹ ਬਿਤਾਉਂਦੇ ਨੇ ਇੱਕ ਤਰਫ਼ ਉਹ ਵਾਲੀ ਬਜ਼ੁਰਗ ਅਬਾਦੀ ਆ ਜਾਂਦੀ ਹੈ ਜਿਹੜੀ ਕਿ ਹੈ ਆਪਣੀ ਜ਼ਿੰਦਗੀ ਦੇ ਇੰਨੇ ਜ਼ਿਆਦਾ ਕਹਿ ਲਉ ਕਿ ਨਾਜ਼ੁਕ ਮੋੜ ਦੇ ਉੱਪਰ ਵੀ ਵੀ ਮਤਲਬ ਜਦੋਂ ਉਹਨਾਂ ਨੂੰ ਉਹਨਾਂ ਦੇ ਬੱਚਿਆਂ ਦੀ ਸਭ ਤੋਂ ਜ਼ਿਆਦਾ ਲੋੜ ਹੈ ਜਦੋਂ ਉਹਨਾਂ ਦਾ ਆਪਣਾ ਸੁਭਾਅ ਜਿਹੜਾ ਹੈ ਅਪ ਉਹ ਵੀ ਬੱਚਿਆਂ ਵਰਗਾ ਹੋਇਆ ਪਿਆ ਹੈ ਉਹਨਾਂ ਦਾ ਆਪਦਾ ਸਰੀਰ ਜਿਹੜਾ ਹੈ ਉਹ ਵੀ ਦੇਖਭਾਲ ਮੰਗਦਾ ਹੈ ਪਰ ਫਿਰ ਵੀ ਜ਼ਿੰਦਗੀ ਦੇ ਅਜਿਹੇ ਮੋੜ 'ਤੇ ਵੀ ਉਹ ਕੰਮ ਕਰਨ ਲਈ ਮਜਬੂਰ ਨੇ ਕਈ ਜਿਹੜੇ ਨੇ ਉਹਨਾਂ ਨੇ ਕਈ ਤਰੀਕੇ ਦੀਆਂ ਕਹਿ ਲਓ ਕਿ ਛੋਟੀਆਂ ਛੋਟੀਆਂ ਦੁਕਾਨਾਂ ਖੋਲੀਆਂ ਹੋਈਆਂ ਜਿਨ੍ਹਾਂ ਦੇ ਵਿੱਚ ਉਹ ਬੱਚਿਆਂ ਦਾ ਛੋਟਾ ਛੋਟਾ ਸਮਾਨ ਰੱਖਦੇ ਹੈ ਕਾਪੀਆਂ ਹੋ ਗਈਆਂ ਪੈਂਸਿਲਜ਼ ਹੋ ਗਈਆਂ ਇਹ ਸਾਰੀਆਂ ਚੀਜ਼ਾਂ ਪਰ ਕਈ ਬਜ਼ੁਰਗ ਜਿਹੜੇ ਨੇ ਜਿਵੇਂ ਰਿਕਸ਼ਾ ਵਗੈਰਾ ਚਲਾਉਂਦੇ ਵੀ ਮੈਂ ਤਰਨ ਤਾਰਨ ਜ਼ਿਲ੍ਹੇ ਵਿੱਚ ਦੇਖੇ ਨੇ ਕਈ ਜਿਹੜੇ ਆ ਉਹ ਜਿਵੇਂ ਮੋਚੀ ਦਾ ਕੰਮ ਕਰਦੇ ਆ ਇਹਦਾ ਦੋ ਪਹਿਲੂ ਨੇ ਇੱਕ ਤਾਂ ਇਹ ਕਿ ਬੜਾ ਵਧੀਆ ਲੱਗਦਾ ਹੈ ਕਿ ਆਪਣੀ ਜ਼ਿੰਦਗੀ ਦੇ ਵਿੱਚ ਵੀ ਜਿੰਨੀ ਦੇਰ ਤੱਕ ਉਹਨਾਂ ਦਾ ਸਰੀਰ ਕਹਿ ਲਉ ਉਹਨਾਂ ਦਾ ਸਾਥ ਦੇ ਰਿਹਾ ਹੈ ਉਹ ਆਪਣੇ ਹੱਥੀਂ ਮਿਹਨਤ ਕਰਕੇ ਖਾਣ ਦੇ ਵਿੱਚ ਯਕੀਨ ਰੱਖਦੇ ਨੇ ਪਰ ਨਾਲ ਦੀ ਨਾਲ ਦੁੱਖ ਵੀ ਹੁੰਦਾ ਹੈ ਇਹ ਸੋਚ ਕੇ ਵੀ ਪਤਾ ਨਹੀਂ ਕੀ ਅਜਿਹੀ ਮਜਬੂਰੀ ਹੋਏਗੀ ਜਿਸਨੇ ਇੰਨਾ ਬਜ਼ੁਰਗਾਂ ਨੂੰ ਜ਼ਿੰਦਗੀ ਦੀ ਆਪਣੇ ਇਸ ਪੜਾਵ ਉੱਤੇ ਵੀ ਕਹਿ ਲਉ ਹੱਡ ਭੰਨਵੀ ਮਿਹਨਤ ਕਰਨ ਦੇ ਲਈ ਮਜਬੂਰ ਕੀਤਾ ਹੋਏਗਾ ਕਿ ਚਾਰ ਚਾਰ ਬੱਚਿਆਂ ਨੂੰ ਇੱਕ ਮਾਂ ਪਿਓ ਜਿਹੜਾ ਹੈ ਉਹ ਪਾਲ ਸਕਦਾ ਹੈ ਪਰ ਚਾਰ ਬੱਚਿਆਂ ਕੋਲੋਂ ਆਪਣੇ ਮਾਂ ਪਿਓ ਜਿਹੜੇ ਸੀਗੇ ਉਹ ਨਹੀਂ ਸਾਂਭੇ ਜਾਂਦੇ ਬੱਚੇ ਜਿਹੜੇ ਨੇ ਉਹ ਰੁਜ਼ਗਾਰ ਦੇ ਲਈ ਦੇਸ਼ ਛੱਡ ਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਜਾਂ ਕਹਿ ਲਓ ਕਿ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਵੱਸ ਰਹੇ ਨੇ ਪਰ ਪਿੱਛੇ ਜਿਹੜੇ ਆ ਉਹਨਾਂ ਦੇ ਮਾਂ ਪਿਓ ਉਹਨਾਂ ਨੇ ਜਿਹੜਾ ਸਮਾਂ ਆਪਣੇ ਬੱਚੇ ਨਾਲ ਬਿਤਾਉਣਾ ਹੁੰਦਾ ਹੈ ਉਹਨਾਂ ਨੂੰ ਇਕੱਲਿਆਂ ਜਿਹੜਾ ਹੈ ਉਹ ਬਤੀਤ ਕਰਨਾ ਪੈਂਦਾ ਹੈ ਫਿਰ ਇਹਦੇ ਨਾਲ ਕਿਸੇ ਵੇਲੇ ਇਹ ਵੀ ਹੋ ਜਾਂਦਾ ਹੈ ਵੀ ਜਿਵੇਂ ਉਹਨਾਂ ਦੀ ਸੋਚ ਦਾ ਅਤੇ ਆਪਣੀ ਸੋਚ ਦਾ ਕਾਫੀ ਫ਼ਰਕ ਹੈਗਾ ਪਰ ਫਿਰ ਵੀ ਬਜ਼ੁਰਗ ਜਿਹੜੇ ਨੇ ਉਹ ਕੋਸ਼ਿਸ਼ ਕਰਦੇ ਨੇ ਕਿ ਨਵੀਂ ਪੀੜ੍ਹੀ ਦੇ ਨਾਲ ਕਹਿ ਲਓ ਮੋਢੇ ਨਾਲ ਮੋਢਾ ਲਾ ਕੇ ਚੱਲ ਸਕਣ ਉਹਨਾਂ ਦੀ ਸੋਚ ਨੂੰ ਅਪਣਾ ਸਕਣ ਪਰ ਫਿਰ ਵੀ ਜੇ ਕਿਤੇ ਉਹ ਚੂਕ ਜਾਂਦੇ ਆ ਜੇ ਕਿਤੇ ਉਹਨਾਂ ਤੋਂ ਕੁਛ ਨਹੀਂ ਹੋ ਪਾਉਂਦਾ ਤਾਂ ਫਿਰ ਅੱਜ ਕੱਲ੍ਹ ਦੀ ਪੀੜ੍ਹੀ ਇੰਨਾ ਜ਼ਿਆਦਾ ਸਬਰ ਘਟਿਆ ਹੋਇਆ ਲੋਕਾਂ ਦੇ ਵਿੱਚ ਕਹਿ ਲਓ ਵੀ ਉਹਨਾਂ ਨੂੰ ਫਿਰ ਮੰਦਾ ਬੋਲਣ ਲੱਗਿਆ ਵੀ ਬਿਲਕੁਲ ਨਹੀਂ ਝਿਜਕਦੇ